ਹੈਲੋ ਮੈਂ ਹਰਮਨਜੀਤ ਕੌਰ ਮੈਂ ਆਪਣੇ ਪੂਰੇ ਪਰਿਵਾਰ ਨਾਲ ਪੂਰੇ ਪਰਿਵਾਰ ਨਾਲ ਹਰ ਸਾਲ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਜਾਂਦੀ ਹਾਂ ਅਤੇ ਇਸ ਵਾਰ ਵੀ ਮੈਂ ਜਾਣ ਦੀ ਸਲਾਹ ਬਣਾਈ ਹੋਈ ਸੀ ਮੈਂ ਤੁਹਾਡੇ ਖਾਲਸਾ ਟੈਕਸੀ ਸਟੈਂਡ ਤੋਂ ਇੱਕ ਟੈਕਸ਼ੀ ਟੈਕਸੀ ਸ਼ਾਮ ਨੂੰ ਹੀ ਬੁੱਕ ਕੀਤੀ ਬੁੱਕ ਕੀਤੀ ਸੀ ਜਿਸ ਵਿੱਚ ਮੈਂ ਅਗਲੇ ਦਿਨ ਨੌ ਵਜੇ ਹੀ ਘਰ ਤੋਂ ਤੁਰਨਾ ਸੀ ਮੈਂ ਤੁਹਾਡੇ ਟਾਇਕਸ ਟੈਕਸੀ ਡਰਾਈਵਰ ਨੂੰ ਕੋਲ ਕੀਤੀ ਅਤੇ ਮੈਂ ਤੁਹਾਡੇ ਟੈਕਸੀ ਡਰਾਈਵਰ ਨੂੰ ਕੋਲ ਕੀਤੀ ਅਤੇ ਕਿਹਾ ਕਿ ਮੈਂ ਕਿ ਮੈਂ ਉਸਨੂੰ ਕਿਹਾ ਕਿ ਤੁਸੀਂ ਕਿੱਥੇ ਹੋ ਅਤੇ ਉਹ ਕਹਿ ਰਹੇ ਸੀ ਕਿ ਮੈਂ ਦਸ ਮਿੰਟ ਤੱਕ ਬਸ ਆਉਣ ਵਾਲਾ ਹੀ ਹਾਂ ਪਰ ਮੈਂ ਵਾਰ ਵਾਰ ਕੋਲ ਕਰਨ 'ਤੇ ਉਸਨੇ ਮੇਰਾ ਕੋਲ ਨਹੀਂ ਚੁੱਕਿਆ ਜਿਸ ਕਰਕੇ ਦਿਨ ਦੇ ਗਿਆਰਾਂ ਵੱਜ ਚੁੱਕੇ ਸੀ ਅਤੇ ਮੇਰਾ ਜਾਣਾ ਕੈਂਸਲ ਹੋ ਗਿਆ ਜਿਸ ਕਰਕੇ ਜੋ ਮੈਂ ਟੈਕਸੀ ਬੁੱਕ ਕੀਤੀ ਸੀ ਉਸਨੂੰ ਕੈਂਸਲ ਕੀਤਾ ਜਾਵੇ ਅਤੇ ਜੋ ਮੈਂ ਤੁਹਾਨੂੰ ਔਨਲਾਈਨ ਪੇਮੈਂਟ ਕੀਤੀ ਸੀ ਉਸਨੂੰ ਵੀ ਮੇਰੇ ਉਸਨੂੰ ਵੀ ਮੇਰਾ ਕੋਲ ਵਾਪਸ ਕੀਤਾ ਜਾਵੇ